ਹਾਂਜੀ ਅੱਛਾ ਜੀ ਹਾਂਜੀ ਸਾਂਭ ਲਾਂਗੇ ਕਿੱਡੇ ਕਿੱਡੇ ਕੁ ਬੱਚੇ ਆ ਠੀਕ ਆ ਜੀ ਅੱਛਾ ਜੀ ਤਿੰਨ ਬੱਚੇ ਆ ਠੀਕ ਅੱਛਾ ਜੀ ਹੋਰ ਅਤੇ ਠੀਕ ਹੈ ਜੀ ਅਤੇ ਉਹਨਾਂ ਨੂੰ ਖਿਲਾਉਣਾ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਹੋਰ ਠੀਕ ਇਹ ਤਾਂ ਜੀ ਹੁਣ ਤੁਸੀਂ ਫਿਰ ਬੱਚਿਆਂ ਨੂੰ ਸਾਂਭਣਾ ਵੀ ਹੈ ਬੱਚਿਆਂ ਨੇ ਧਿਆਨ ਨਾਲ ਰੱਖਣਾ ਬੱਚਿਆਂ ਦਾ ਵੀ ਸਾਰਾ ਸਾਂਭਣ ਸਭੱਈਆ ਨਹਾਉਣਾ ਧਮਾਉਣਾ ਕੋਈ ਪੋਟੀ ਕਰਨੀ ਬੱਚੇ ਨੇ ਜਾਂ ਕੋਈ ਪਿਸ਼ਾਬ ਪੁਸ਼ਾਬ ਕਰਨਾ ਉਹ ਵੀ ਸਾਂਭਣਾ ਹੈ ਇਹ ਤਾਂ ਹੁਣ ਤੁਸੀਂ ਆਪ ਬੱਚਿਆਂ ਦੇ ਹਿਸਾਬ ਨਾਲ ਦੱਸੋ ਕਿੰਨੇ ਕੁ ਦੇਵੋਗੇ ਅਤੇ ਕਿੰਨੇ ਕੁ ਮੈਂ ਲਵਾਂਗੀ ਤੁਸੀਂ ਦੱਸੋ ਕਿੰਨੇ ਕ ਦੇ ਸਕਦੇ ਹੋ ਠੀਕ ਹੈ ਠੀਕ ਹੈਜੀ ਕੈ ਤੋਂ ਕੈ ਤੱਕ ਕੈ ਵਜੇ ਆਇਆ ਕਰਾਂ ਪੈਸੇ ਦੱਸੋ ਤੁਸੀਂ ਕਿੰਨੇ ਦੇਵੋਗੇ ਠੀਕ ਆ ਜੀ ਪੰਜ ਤਾਂ ਜੀ ਥੋੜ੍ਹਾ ਐਂ ਤਾਂ ਗੁਜ਼ਾਰਾ ਨਹੀਂ ਹੋਣਾ ਹਾਂਜੀ ਹਾਂਜੀ ਭਰਿਆ ਪਿਆ ਮੇਰਾ ਬੱਚੇ ਸਾਂਭੇ ਵੇ ਨੇ ਮੇਰੇ ਮੈਂ ਸਕੂਲ 'ਚ ਕੰਮ ਕਰਿਆ ਜੀ ਬੱਚੇ ਸਾਂਭੇ ਅਸੀਂ ਹਾਂਜੀ ਕੋਈ ਗੱਲ ਨਹੀਂ ਬੱਚਿਆਂ ਦਾ ਪੂਰਾ ਧਿਆਨ ਹੋਊ ਜਿਹੋ ਜਿਹੇ ਆਪਣੇ ਉਹੋ ਜਿਹੇ ਇਹ ਆ ਹਾਂਜੀ ਪੈਸੇ ਤਾਂ ਤੁਸੀਂ ਤਨਖਾਹ ਤਾਂ ਜੀ ਘੱਟ ਆ ਇਹ ਪੰਜ ਹਜ਼ਾਰ ਤਾਂ ਜੀ ਥੋੜ੍ਹਾ ਬੱਚਿਆਂ ਦਾ ਸਾਂਭਣਾ ਵੀ ਬਹੁਤ ਕੁਛ ਆ ਤੁਹਾਨੂੰ ਪਤਾ ਤਾਂ ਹੈ ਬੱਚਿਆਂ ਦਾ ਸਾਂਭਣਾ ਹਾਂ ਬੱਚੇ ਦੇ ਕੋਈ ਢਿੱਲ ਮੱਥ ਹੁੰਦੀ ਹੈ ਦਵਾਈ ਬੂਟੀ ਵੀ ਦੇਣੀ ਬੱਚੇ ਨੂੰ ਪੋਟੀ ਵੀ ਕਰੂ ਬੱਚਾ ਉਹ ਵੀ ਧੋਣਾ ਕੋਈ ਕੱਪੜੇ ਵੀ ਬਦਲੀ ਕਰਨੇ ਨਾ ਦੇਖ ਲਿਓ ਤੁਸੀਂ ਗਰੀਬਣੀ ਕੰਨੀ ਦੇਖ ਲਿਓ ਜੀ ਠੀਕ ਹੈ ਨਾ ਹਾਂ ਅਸੀਂ ਤਾਂ ਇਹ ਇਹ ਇਹ ਹੀ ਕਰਨਾ ਅਤੇ ਇਹ ਹੀ ਖਾਣਾ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ